ਹੈਲੋ ਹਾਂ ਹਾਂਜੀ ਸਰ ਐਸ ਡੀ ਕੰਨਿਆ ਕੋਲਜ ਬਰਨਾਲਾ ਤੋਂ ਬੋਲ ਰਹੇ ਹੋ ਹਾਂ ਮੈਂ ਤੁਹਾਡੇ ਤੋਂ ਕੋਰਸਿਸ ਬਾਰੇ ਇਨਫੋਰਮੇਸ਼ਨ ਲੈਣੀ ਸੀ ਮੈਂ ਪਲਸ ਟੂ ਪਾਸ ਆਊਟ ਕੀਤੀ ਹੈ ਫਿਲਹਾਲ ਹੀ ਅਤੇ ਮੈਂ ਅੱਗੇ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਕਿ ਕਿਸ ਮਤਲਬ ਮੈਂ ਕਿਸ ਸਟਰੀਮ 'ਚ ਜਾਵਾਂ ਜਿਹੜਾ ਮੇਰੇ ਲਈ ਬੈਨੀਫਿਸ਼ਅਲ ਹੋਵੇ ਅੱਗੇ ਮੇਰਾ ਬਿਜ਼ਨਸ ਦੇ ਵਿੱਚ ਹੀ ਹੈ ਸਰ ਮੈਂ ਪਲਸ ਟੂ ਵੀ ਕਮਰਸ 'ਚ ਕੀਤੀ ਹੈ ਅਤੇ ਉਸ ਦਾ ਸਬਜੈਕਟ ਸੀ ਬਿਜ਼ਨਸ ਬਿਜ਼ਨਸ ਮਨੇਜਮੈਂਟ ਹਾਂਜੀ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਸਰ ਠੀਕ ਹੈ ਠੀਕ ਹੈ ਸਰ ਅਤੇ ਜਿੱਦਾਂ ਤੁਸੀਂ ਬੀ ਕੋਮ ਐਮ ਕੋਮ ਕਹਿ ਕਰ ਕਹਿ ਰਹੇ ਹੋ ਕਿ ਮੇਰੀ ਜੋਬ ਲੱਗ ਸਕਦੀ ਹੈ ਬੀਂਗ ਏ ਟੀਚਰ ਵਗੈਰਾ ਅਤੇ ਇਸ ਦਾ ਪੈਕੇਜ ਜਾਣ ਸਕਦੇ ਹਾਂ ਸਰ ਕਿੰਨਾ ਕੁ ਉਹ ਮਤਲਬ ਕਿੰਨੇ ਕੁ ਤੱਕ ਮੈਨੂੰ ਮਿਲ ਜਾਏਗੀ ਸੈਲਰੀ ਠੀਕ ਹੈ ਠੀਕ ਹੈ ਔਰ ਅਗਰ ਬਿਜ਼ਨਸ ਮੈਨੇਜਮੈਂਟ ਕਰਕੇ ਕਹਿ ਰਹੇ ਹੋ ਤੁਸੀਂ ਕਿ ਆਪਣਾ ਬਿਜ਼ਨਸ ਸ਼ੁਰੂ ਕਰਦੇ ਹੋ ਤਾਂ ਉਸ 'ਚ ਮੇਰੀ ਇਨਵੈਸਟਮੈਂਟ ਕਿ ਕਿੰਨੀ ਕੁ ਮੈਨੂੰ ਕੈਪੀਟਲ ਲਗਾਉਣੀ ਪਏਗੀ ਠੀਕ ਹੈ ਸਰ ਠੀਕ ਹੈ ਸਰ ਮੈਂ ਪਲਸ ਟੂ 'ਚ ਸਰ ਕਮਰਸ ਕੀਤੀ ਆ ਹਾਂਜੀ ਠੀਕ ਹੈ ਸਰ ਅਤੇ ਇਹ ਕੋਰਸਿਸ ਵਗੈਰਾ ਫਿਰ ਤੁਹਾਡੇ ਕਦੋਂ ਤੋਂ ਸਟਾਰਟ ਹੋ ਰਹੇ ਹੈ ਠੀਕ ਹੈ ਜੀ

ਮੇਰੀ ਬੀ ਸੀ ਏ ਸਰ ਠੀਕ ਹੈ ਸਰ ਅਤੇ ਕੋਈ ਕਨਸੈਸਨ ਵਗੈਰਾ ਕੋਈ ਕਨਸੈਸਨ ਵਗੈਰਾ ਕਿ ਜਿੱਦਾਂ ਮੇਰੀ ਬੀ ਸੀ ਕਾਸਟ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਸਰ ਮੈਂ ਤੁਹਾਡਾ ਕੋਲਜ ਵਿਜਿਟ ਕਰ ਲੂੰਗੀ ਅਤੇ ਠੀਕ ਹੈ ਸਰ ਜਿਵੇਂ ਫਿਰ ਮੈਨੂੰ ਸਹੀ ਲੱਗਿਆ ਅੱਗੇ ਮੈਂ ਫਰਦਰ ਪ੍ਰੋਸੀਡ ਕਰ ਲੂੰਗੀ ਮੈਂ ਕੋਲਜ ਵਿਜਿਟ ਕਰੂੰ ਤੁਹਾਡਾ ਸਰ ਮੇਰਾ ਪ੍ਰਿਅੰਕਾ

ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਹਾਂ